ਮੈਂ ਸ਼ੀਤਲ ਕੁਮਾਰੀ ਵਾਸੀ ਮਿਰਜ਼ਾਪੁਰ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜੀਵਨ ਵਿੱਚ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੇ ਸਾਡੇ ਆਵਜਾਈ ਦੇ ਸਾਧਨਾਂ ਜਾ ਇੱਧਰ ਉੱਧਰ ਘੁੰਮਣ ਦੇ ਸਾਧਨਾਂ ਦੇ ਨਾਲ ਸਾਨੂੰ ਬੜੀ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਅੱਜ ਅਜਿਹਾ ਦੌੌਰ ਹੈ ਕਿ ਹਰ ਇੱਕ ਇਨਸਾਨ ਹਰ ਇੱਕ ਇਨਸਾਨ ਜਿਹੜਾ ਕਿ ਬਾਇਕ ਸਕੂਟਰ ਆਦਿ 'ਤੇ ਤੁਰਨਾ ਫਿਰਦਾ ਹੈ ਉਸ ਨੂੰ ਉਸ ਵਿੱਚ ਤੇਲ ਪਾਉਣਾ ਹੀ ਪੈਂਦਾ ਹੈ ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਜਦੋਂ ਦੋ ਤਿੰਨ ਰੁਪਏ ਪੈਟਰੋਲ ਮਹਿੰਗਾ ਹੁੰਦਾ ਹੈ ਤਾਂ ਇੱਕ ਇਨਸਾਨ ਸੋਚਦਾ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਪਰ ਜਦੋਂ ਕੋਈ ਆਪਣੀ ਬਾਈਕ ਜਾਂ ਕਾਰ ਵਿੱਚ ਹਜ਼ਾਰਾਂ ਲੀਟਰ ਪੈਟਰੋਲ ਪਵਾ ਕੇ ਹਿਸਾਬ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਦੋ ਤਿੰਨ ਰੁਪਏ ਵਧਣ ਨਾਲ ਮੇਰਾ ਮੇਰੇ ਜੇਬ ਦੇ ਕਿੰਨਾ ਭਾਰ ਪੈ ਰਿਹਾ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪੈਟਰੋਲ ਦੀ ਮਹਿੰਗਾਈ ਨੇ ਸਾਨੂੰ ਬੜਾ ਹੀ ਤੰਗ ਕਰ ਦਿੱਤਾ ਹੈ ਜੇਕਰ ਅਸੀਂ ਬਾਲਣ ਦੀ ਗੱਲ ਕਰੀਏ ਕਿ ਬਾਲਣ ਬਾਲਣਾ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਕਰ ਦਿੰਦਾ ਹੈ ਪ੍ਰਦੂਸ਼ਣ ਨਾਲ ਸਾਡਾ ਵਾਤਾਵਰਨ ਭਰ ਜਾਂਦਾ ਹੈ ਪਰ ਅੱਜ ਇਸ ਦਾ ਰੋਲ ਕਰਿਆ ਜਾ ਰਿਹਾ ਹੈ ਕਿਉਂਕਿ ਬਾਲਣ ਲੋਕ ਘੱਟ ਹੀ ਯੋਗ ਕਰਦੇ ਹਨ ਇਸ ਇਸ ਦੀ ਜਗ੍ਹਾ ਗੈਸਾਂ ਨੇ ਲੈ ਲਈ ਹੈ ਜਾਂ ਇਸ ਦੀ ਜਗ੍ਹਾ ਬਿਜਲੀ ਨੇ ਚੱਲਣ ਵਾਲੀਆਂ ਭੱਠੀਆਂ ਨੇ ਲੈ ਲਈ ਹੈ ਇਹਨਾਂ ਦਾ ਜੇਬ ਘਟਦਾ ਜਾ ਰਿਹਾ ਹੈ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਬਾਲਣ ਨਾਲ ਵਾਤਾਵਰਨ ਦਾ ਖਰਾਬ ਹੋਣਾ ਤਾਂ ਠੀਕ ਹੈ ਪਰ ਅੱਜ ਇਸਦਾ ਦੌਰ ਬੜਾ ਹੀ ਘੱਟ ਗਿਆ ਹੈ ਅਤੇ ਸਾਨੂੰ ਇਸਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ ਕਿਉਂਕਿ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦਾ ਇਹ ਸਾਡਾ ਜੀਵਨ ਪੂਰੀ ਤਰ੍ਹਾਂ ਨਾਲ ਖੁਸ਼ਹਾਲ ਹੋ ਕੇ ਧੰਨਵਾਦ ਜੀ